ਪੰਜ ਜੂਨ ਉੱਨੀ ਸੌ ਚੁਰਾਸੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਉਨੱਤੀ ਮਾਰਚ ਉੱਨੀ ਸੌ ਅਠਾਨਵੇਂ ਚੌਵੀ ਨਵੰਬਰ ਉੱਨੀ ਸੌ ਛਿਆਨਵੇਂ ਗਿਆਰਾਂ ਜੁਲਾਈ ਉੱਨੀ ਸੌ ਪਚਾਨਵੇਂ